ਭੰਗੜਾ ਐਰੋਬਿਕਸ ਦੀ ਰੋਜ਼ ਹੀ ਸ਼ਾਮ ਨੂੰ ਇੱਕ ਕਲਾਸ ਹੁੰਦੀ ਹੈ ਇਕ ਘੰਟੇ ਦੀ ਕਲਾਸ ਹੁੰਦੀ ਹੈ ਸ਼ਾਮ ਨੂੰ ਪੰਜ ਤੋਂ ਛੇ ਵਜੇ ਦੀ ਕਲਾਸ ਹੁੰਦੀ ਹੈ ਅਤੇ ਜਿੱਦਾਂ ਹੀ ਆਪਾਂ ਕਲਾਸ ਵਿੱਚ ਜਾਈਦਾ ਇਹ ਥੋੜ੍ਹੇ ਜਿਹੇ ਕੱਪੜੇ ਚੇਂਜ ਕਰੀਦੇ ਅਤੇ ਉਸ ਤੋਂ ਬਾਅਦ ਦੋ ਚਾਰ ਮਿੰਟ ਪੰਜ ਮਿੰਟ ਐਕਸਰਸਾਈਜ਼ ਸ਼ੁਰੂ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਭੰਗੜਾ ਐਰੋਬਿਕਸ ਸ਼ੁਰੂ ਕਰ ਦਿੱਤਾ ਜਾਂਦਾ ਅਤੇ ਪਹਿਲਾਂ ਦਸ ਜਾਂ ਪੰਦਰ੍ਹਾਂ ਮਿੰਟ ਦਾ ਇੱਕ ਸਟੈਪ ਹੁੰਦਾ ਉਸ ਤੋਂ ਬਾਅਦ ਹਰ ਪੰਦਰ੍ਹਾਂ ਮਿੰਟ ਜਾਂ ਵੀਹ ਮਿੰਟ ਬਾਅਦ ਦੋ ਚਾਰ ਮਿੰਟ ਦੀ ਜਾਂ ਪੰਜ ਮਿੰਟ ਦੀ ਬਰੇਕ ਹੁੰਦੀ ਹੈ ਅਤੇ ਹਰ ਬਰੇਕ ਵਿੱਚ ਥੋੜ੍ਹਾ ਜਿਹਾ ਰੈਸਟ ਕਰਕੇ ਅਤੇ ਉਸ ਤੋਂ ਬਾਅਦ ਫਿਰ ਸਟਾਰਟ ਕਰ ਦਿੱਤਾ ਜਾਂਦਾ ਇਸ ਕਰਕੇ ਡੇਲੀ ਦੀ ਰੂਟੀਨ ਹੈ ਹੈਗੀ ਆ ਕਿ ਪੰਜ ਵਜੇ ਤੋਂ ਲੈ ਕੇ ਛੇ ਵਜੇ ਤੱਕ ਭੰਗੜਾ ਐਰੋਬਿਕਸ ਕਰਨਾ ਇਸ ਕਰਕੇ ਤੁਹਾਡੇ ਸਰੀਰ ਦਾ ਵੀ ਨੂੰ ਵੀ ਫਿੱਟ ਬਣਾਉਣ ਲਈ ਬਹੁਤ ਹੀ ਵਧੀਆ ਭੰਗੜਾ ਐਰੋਬਿਕਸ ਹੈ ਹਰ ਕਿਸੇ ਨੂੰ ਕਰਨਾ ਚਾਹੀਦਾ ਭੰਗੜਾ ਐਰੋਬਿਕਸ ਛੇ ਵਜੇ ਤੋਂ ਬਾਅਦ ਖਤਮ ਹੁੰਦਾ ਅਤੇ ਦੋ ਚਾਰ ਮਿੰਟ ਪੰਜ ਮਿੰਟ ਰੈਸਟ ਕਰਕੇ ਅਤੇ ਆਪਣੇ ਕੱਪੜੇ ਚੇਂਜ ਕਰਕੇ ਅਤੇ ਵਾਪਿਸ ਆ ਜਾਂਦਾ ਬਸ ਇਹ ਭੰਗੜਾ ਐਰੋਬਿਕਸ ਦੀ ਡੇਲੀ ਦਾ ਰੂਟੀਨ ਹੈਗਾ ਸਾਡਾ